ਡਰਾਇੰਗ ਔਰ ਪੇਂਟਿੰਗ ਵਰਗੀਆਂ ਕਲਾਵਾਂ ਲਈ ਸਹੀ ਉਮਰ ਮੇਰੇ ਮੁਤਾਬਿਕ ਤਾਂ ਅੱਠ ਤੋਂ ਬਾਰ੍ਹਾਂ ਸਾਲ ਦੀ ਹੋਣ ਹੈਗੀ ਹੈ ਅਤੇ ਪਰ ਇਹਦੇ ਇਹਦੇ 'ਚ ਜਦ ਤੱਕ ਆਪ ਡਿ ਦਿਸਚਸਪੀ ਨਹੀਂ ਹੁੰਦੀ ਕਿਸੇ ਵੀ ਚੀਜ਼ ਨੂੰ ਕਰਨ ਲਈ ਦਿਲ ਮਤਲਬ ਪੇਂਟਿੰਗ ਹੋਏ ਔਰ ਕਲਾਵਾਂ ਕੋਈ ਵੀ ਕਲਾਵਾਂ ਹੋਣ ਡਰਾਇੰਗ ਪੇਂਟਿੰਗ ਹੋਣ ਇਹਨਾਂ ਲਈ ਸਹੀ ਉਮਰ ਅੱਠ ਤੋਂ ਬਾਰ੍ਹਾਂ ਹੋਣ ਦੇ ਨਾਲ਼ ਦਿਲਚ ਦਿਲਚਸਪੀ ਜ਼ਰੂਰ ਹੋਣੀ ਚਾਹੀਦੀ ਹੈ ਜਿਹਦੇ ਨਾਲ਼ ਇਹ ਅੱਗੇ ਜਿਹੜਾ ਹੈਗਾ ਪੂਰੇ ਉਤਸਾਹ ਨਾਲ਼ ਇਹ ਕੰਮ ਕੀਤਾ ਜਾਂਦਾ ਹੈ